ਪੰਛੀਆਂ ਦਾ ਉੱਡਣ ਦਾ ਸਟਾਈਲ ਆਪਣਾ ਆਪਣਾ ਹੀ ਹੁੰਦਾ ਹੈ ਜਿਵੇਂ ਕਿ ਤੋਤੇ ਇੱਲਾਂ ਬਾਜ ਚਿੜੀਆਂ ਚਿੜੀਆਂ ਗੂੰਜਾਂ ਬਗਲੇ ਆਪੋ ਆਪਣੇ ਸਟਾਈਲ 'ਚ ਕਬੂਤਰ ਆਪੋ ਆਪਣੇ ਸਟੈਲਾ ਚ ਉੱਡਦੇ ਹਨ ਮੈਨੂੰ ਸਭ ਤੋਂ ਵੱਧ ਵਧੀਆ ਕੂੰਜਾਂ ਦੀ ਉਡਾਨ ਹੀ ਲੱਗਦੀ ਹੈ ਕਿਉਂਕਿ ਉਹ ਇੱਕ ਏਕਤਾ ਦੇ ਵਿੱਚ ਚੱਲ ਰਹੀਆਂ ਹੁੰਦੀਆਂ ਹਨ ਅਤੇ ਵੇਖਣ ਨੂੰ ਵੀ ਬਹੁਤ ਹੀ ਸੁੰਦਰ ਲੱਗਦੀਆਂ ਹੁੰਦੀਆਂ ਹਨ ਇੱਕ ਲੈਅ ਵਿੱਚ ਚੱਲ ਰਹੀਆਂ ਹੁੰਦੀਆਂ ਹਨ